ਹੈਲੋ ਸਰ ਗੁੱਡ ਈਵਨਿੰਗ ਤੁਸੀਂ ਬਠਿੰਡਾ ਤੋਂ ਸੰਧੂ ਕਾਰ ਏਜੰਸੀ ਤੋਂ ਬੋਲ ਰਹੇ ਹੋ ਸਰ ਮੈਂ ਘੁੱਦਾ ਪਿੰਡ ਤੋਂ ਬੋਲ ਰਹੀ ਹਾਂ ਮਮਤਾ ਰਾਣੀ ਸਰ ਐਕਚੁਲੀ ਐਦਾਂ ਸੀ ਅਸੀਂ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ 'ਚ ਬਾਹਰ ਘੁੰਮਣ ਵਾਸਤੇ ਵੋਕੇਸ਼ਨ 'ਤੇ ਲੈ ਕੇ ਜਾਣਾ ਸੀ ਜੀ ਸ਼ਿਮਲਾ ਸਰ ਤੁਹਾਡੇ ਕੋਲ ਕਿਹੜੀ ਕਿਹੜੀ ਕਾਰਜ਼ ਕੈਬ ਉਪਲਬਧ ਨੇ ਤੁਹਾਡੀ ਏਜੰਸੀ ਵਿੱਚ ਅਤੇ ਮੈਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਪਲੀਜ ਸਰ ਅਸੀਂ ਪੰਦਰ੍ਹਾਂ ਜੂਨ ਤੋਂ ਬਾਅਦ ਸ਼ਿਮਲਾ ਘੁੰਮਣ ਜਾਣਾ ਜੀ ਸਾਡੇ ਨਾਲ ਬੱਚੇ ਵੀ ਹੈ ਬਜ਼ੁਰਗ ਵੀ ਹੈ ਅਸੀਂ ਪੰਜ ਛੇ ਜਣੇ ਹੈ ਸਰ ਮੈਨੂੰ ਗੱਡੀ ਜਾਂ ਕੈਬ ਦੀ ਜ਼ਰੂਰਤ ਹੈ ਸਰ ਗੱਡੀ ਹੈ ਘਰ ਪਰ ਸਾਡੇ ਕੋਈ ਗੱਡੀ ਡਰਾਈਵਿੰਗ ਕਰਨ ਵਾਲਾ ਹੈ ਨੀਗਾ ਸਰ ਮੈਨੂੰ ਅੱਛੀ ਕੈਬ ਜਿਹਦੇ ਵਿੱਚ ਏ ਸੀ ਉਪਲਬਧ ਹੋਵੇ ਇੰਜਣ ਵਗੈਰਾ ਸਹੀ ਹੋਵੇ ਗੱਡੀ ਪੂਰੀ ਵਧੀਆ ਹੋਵੇ ਮੈਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਸਰ ਕਿੰਨੇ ਪੈਸੇ ਲੱਗਣਗੇ ਕੀ ਪੇਮੈਂਟ ਹੋਊਗੀ ਬਟ ਸਰ ਦੂਸਰੀ ਗੱਲ ਇਹ ਹੈ ਸਰ ਡਰਾਈਵੀਅਰ ਡਰਾਈਵਰ ਪੂਰਾ ਵਧੀਆ ਹੋਵੇ ਐਕਸਪੀਰੀਅੰਸ ਹੋਵੇ ਐਕਸਪਰਟ ਹੋਵੇ ਗੱਡੀ ਚਲਾਉਣ 'ਚ ਡਰਾਈਵਰ ਕੋਈ ਨਸ਼ਾ ਨਾ ਕਰਦਾ ਹੋਵੇ ਬਿਨਾ ਨਸ਼ੇ ਤੋਂ ਰਹਿਤ ਹੋਵੇ ਡਰਾਈਵਰ ਸਰ ਮੈਨੂੰ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਸੀ ਵੀ ਕਿੰਨੀ ਪੇਮੈਂਟ ਲੱਗੇਗੀ ਸ਼ਿਮਲੇ ਜਾਣਾ ਅਸੀਂ ਚਾਰ ਦਿਨਾਂ ਵਾਸਤੇ ਜਾਣਾ ਸਰ ਦੋ ਸਾਡੇ ਨਾਲ ਬੱਚੇ ਆ ਦੋ ਬਜ਼ੁਰਗ ਆ ਅਸੀਂ ਪੰਜ ਜਾਂ ਛੇ ਜਣੇ ਹੋਵਾਂਗੇ ਅਤੇ ਤੁਸੀਂ ਸਰ ਪਲੀਜ਼ ਮੈਨੂੰ ਇਸ ਨੰਬਰ 'ਤੇ ਕਾਲ ਕਰਕੇ ਕੱਲ੍ਹ ਸ਼ਾਮ ਤੱਕ ਦੱਸ ਦੋਗੇ ਜੀ ਕਿਹੜੀ ਤੁਹਾਡੇ ਕੋਲ ਗੱਡੀ ਉਪਲਬਧ ਹੈ ਕੈਬ ਹੈ ਜਾਂ ਕੋਈ ਗੱਡੀ ਹੈ ਜਾਂ ਕੋਈ ਹੋਰ ਕਾਰ ਹੈ ਕਿਸ ਤਰ੍ਹਾਂ ਦੀ ਵੀ ਹੈ ਮੈਨੂੰ ਸ਼ਾਮੀ ਇਸ ਨੰਬਰ 'ਤੇ ਕਾਲ ਕਰਕੇ ਜਾਂ ਵਟਸਐਪ ਕਰਕੇ ਤੁਸੀਂ ਪਲੀਜ਼ ਦੱਸਣ ਦੀ ਕਿਰਪਾਲਤਾ ਕਰਨੀ ਥੈਂਕ ਯੂ ਸਰ ਮੇਰਾ ਨਾਮ ਮਮਤਾ ਰਾਣੀ ਮੈਂ ਝੁੰਬੇ ਤੋਂ ਬੋਲ ਘੁੱਦਾ ਪਿੰਡ ਤੋਂ ਬੋਲ ਰਹੀ ਹਾਂ ਵੈਰੀ ਵੈਰੀ ਥੈਂਕ ਯੂ